ਤੁਸੀਂ ਨੀਸ਼ਾ ਮੈਮ ਬੋਲ ਰਹੇ ਹੋ ਮੈਮ ਇਹ ਨੰਬਰ ਮੇਰੇ ਦੋਸਤ ਨੇ ਦਿੱਤਾ ਸੀਗਾ ਕਹਿੰਦਾ ਤੁਸੀਂ ਡਾਕਟਰ ਵਧੀਆ ਹੈਗੇ ਦਵਾਈ ਵਧੀਆ ਦਿੰਦੇ ਨੇ ਇਹਨਾਂ ਤੋਂ ਗੱਲ ਕਰ ਲੈ ਅਤੇ ਮੈਨੂੰ ਨਾ ਬਿਮਾਰੀ ਬੁਖਾਰ ਹੋਇਆ ਵਾ ਅਤੇ ਛਾਤੀ 'ਚ ਦਰਦ ਵੀ ਹੁੰਦਾ ਹਾਂਜੀ ਅਤੇ ਇੱਕ ਬਲਗਮ ਵੀ ਹਾਂ ਹੈਗਾ ਰੋਟੀ ਖਾਧੀ ਸੀਗੀ ਸਬਜ਼ੀ ਉਸ ਤੋਂ ਪਹਿਲਾਂ ਮੈਂ ਆਈਸਕ੍ਰੀਮ ਵੀ ਖਾਧਾ ਸੀਗਾ

ਅੱਛਾ ਜੀ ਅਤੇ ਮੈਨੂੰ ਕਿਆ ਕਿਆ ਚੀਜ਼ ਨਹੀਂ ਖਾਣਾ ਚਾਹੀਦਾ ਇਹਦੇ ਵਿੱਚ ਅੱਛਾ ਜੀ ਹਾਂਜੀ ਦਲੀਆ ਮੈਮ ਮੈਂ ਦਲੀਆ ਖਾਂਦਾ ਹੁੰਦਾ

ਦੋ ਦੋ ਘੰਟੇ ਬਾਅਦ

ਅੱਛਾ ਜੂਸ ਕਾਹਦਾ ਕਾਹਦਾ ਜੂਸ ਹਾਂਜੀ ਇਹ ਇਹ ਸਭ ਨੁਕਸਾਨ ਨਹੀਂ ਕਰਦੀਆਂ ਸਰ ਸਰਦੀਆਂ 'ਚ ਠੀਕ ਆ ਜੀ ਥੈਂਕ ਯੂ ਨਹੀਂ ਹੋਰ ਕੁਛ ਨਹੀਂ ਹਾਂਜੀ ਸਹੀ ਹੈ

ਹਾਂਜੀ ਤੁਸੀਂ ਐ ਐਡਰੈੱਸ ਸੈਂਡ ਕਰ ਦਿਓ ਓਕੇ ਹਾਂਜੀ ਹਾਂਜੀ ਮਿਰਾਜ ਵਾਰਿਸ ਮਿਰਾਜ ਵਾਰਿਸ ਹਾਂਜੀ ਠੀਕ ਹੈ ਥੈਂਕ ਯੂ ਮੈਮ